ਅੱਜ ਦੇ ਸਮੇਂ ਵਿੱਚ ਫੋਟੋਗ੍ਰਾਫਰ ਦੀ ਭੂਮਿਕਾ ਕਾਫੀ ਬਦਲ ਗਈ ਹੈ ਪਹਿਲੇ ਸਮੇਂ ਵਿੱਚ ਫੋਟੋਆਂ ਵਿਆਹ ਸ਼ਾਦੀਆਂ ਪਾਰਟੀਆਂ ਆਦਿ ਵਿੱਚ ਇੱਕ ਪੇਸ਼ੇ ਵਜੋਂ ਫੋਟੋਗ੍ਰਾਫਰ ਦੁਆਰਾ ਖਿੱਚੀਆਂ ਜਾਂਦੀਆਂ ਸਨ ਪਰ ਅੱਜ ਦੇ ਸਮੇਂ ਵਿੱਚ ਟੈਕਨੋਲਜੀ ਦੀ ਤਰੱਕੀ ਨੇ ਇੱਕ ਆਮ ਆਦਮੀ ਨੂੰ ਵੀ ਕੈਮਰਾ ਅਤੇ ਫੋਨ ਉਸ ਦੀ ਪਹੁੰਚ ਵਿੱਚ ਆ ਚੁੱਕੇ ਹਨ ਪਹਿਲੇ ਸਮੇਂ ਵਿੱਚ ਕਿਸੇ ਕਿਸੇ ਕੋਲ ਫੋਨ ਵੇਖਣ ਨੂੰ ਮਿਲਦੇ ਸਨ ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਕੋਲ ਮੋਬਾਈਲ ਫੋਨ ਹਨ ਜਿਸ ਵਿੱਚ ਕੈਮਰਾ ਉਪਲਬਧ ਹੈ ਜ਼ਿਆਦਾਤਰ ਇਨਸਾਨ ਫੋਟੋਗ੍ਰਾਫੀ ਵੀ ਦੇ ਸ਼ੌਕੀਨ ਹਨ ਅਤੇ ਫੋਟੋਆਂ ਵੀ ਖਿੱਚਦੇ ਹਨ ਹਰ ਇੱਕ ਵਿੱਚ ਪ੍ਰਤਿਯੋਗਿਤਾ ਦੀ ਦੌੜ ਲੱਗੀ ਹੋਈ ਹੈ ਇਸ ਦਾ ਅਸਰ ਚੰਗਾ ਵੀ ਹੈ ਪਰ ਕਾਫੀ ਬੁਰਾ ਵੀ ਹੈ ਕਾਫੀ ਘਟਨਾਵਾਂ ਦਾ ਕਾਰਨ ਵੀ ਬਣਦਾ ਹੈ ਇਸ ਕਰਕੇ ਸਾਨੂੰ ਟੈਕਨੋਲਜੀ ਦੀ ਵਰਤੋਂ ਹਿਸਾਬ ਨਾਲ ਕਰਨੀ ਚਾਹੀਦੀ ਹੈ ਜਿਸ ਦਾ ਪ੍ਰਭਾਵ ਬੁਰਾ ਨਾ ਹੋਵੇ ਇਸ ਨੂੰ ਸ਼ੌਕ ਦੇ ਤੌਰ 'ਤੇ ਹੀ ਵਰਤਿਆ ਜਾਵੇ